ਪੰਜਾਬੀ ਭਾਸ਼ਾ ਦੇ ਰਾਹ 'ਤੇ ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਨੂੰ ਵਿਕਸਿਤ ਕਰਨ ਲਈ ਵੱਖ ਵੱਖ ਰੂਪ ਵਿੱਚ ਅਮਲ ਹੋ ਰਿਹਾ ਹੈ ਇਸ ਭਾਸ਼ਾ ਨੇ ਆਪਣੇ ਰੂਪ ਦੀ ਰੀਤ ਵਿੱਚ ਵਿਕਾਸ ਕੀਤਾ ਹੈ ਸਾਹਿਤਕਾਰ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਪੰਜਾਬੀ ਸਾਹਿਤ ਨੇ ਆਪਣੀ ਇਸ ਭਾਸ਼ਾ ਵਿੱਚ ਲਿਖੇ ਗਏ ਕਹਾਣੀਆਂ ਨਾਟਕ ਕਵਿਤਾਵਾਂ ਅਤੇ ਰੀਤਾਂ ਸਾਹਿਤਕਾਰ ਸਾਵਦਾਵਾਂ ਹਨ ਇਸ ਇਹ ਸਾਹਿਤਕਾਰ ਰੂਪ ਆਪਣੇ ਸਥਾਨ ਵਿੱਚ ਅਨੇਕ ਸਮਾਜਿਕ ਅਤੇ ਰਾਜਨੈਤਿਕ ਮੁੱਦਿਆਂ 'ਤੇ ਵਿਚਾਰ ਰੱਖਦਾ ਹੈ ਕਵਿ ਕਵਿਤਾ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਕਵਿਤਕਾਰ ਆਪਣੇ ਦ੍ਰਿਸ਼ਟੀਕੋਣ ਦੇ ਹਿਸਾਬ ਨਾਲ ਵਿੱਚ ਇਸ ਵਿੱਚ ਕਵਿਤਾ ਵਿੱਚ ਲੋਕਾਂ ਨੂੰ ਮੋਟੀਵੇਟ ਕਰਦਾ ਹੈ ਲੋਕਾਂ ਨੂੰ ਸਮਝਾਉਂਦਾ ਹੈ ਲੋਕਾਂ 'ਤੇ ਚੰਗੀ ਚੀਜ਼ਾਂ ਬਾਰੇ ਦੱਸਦਾ ਹੈ ਕਵਿਤਾ ਦੇ ਰੂਪ ਵਿੱਚ ਉਹ ਇੱਕ ਕਹਾਣੀ ਦੱਸਦਾ ਹੈ ਕਲਾ ਕਲਾਤਮਕ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਕਲਾਕਾਰ ਇੱਕ ਨਾਟਕ ਪੇਸ਼ ਕਰਦਾ ਹੈ ਜਾਂ ਪੇਂਟਿੰਗ ਕਰਦਾ ਹੈ ਤਾਂ ਉਸ ਵਿੱਚ ਉਸ ਮਨੁੱਖੀ ਦੇ ਦੁੱਖ ਦਰਦ ਸਭ ਕੁਛ ਦਰਸਾਉਂਦਾ ਹੈ